ਲੈਂਡਸਕੇਪ ਡਰਾਇੰਗ ਵਿੱਚ ਮੋਡ ਬਣਾਉਣ ਲਈ ਰੰਗ ਛਾਵਾਂ ਅਤੇ ਸ਼ੇਡਿੰਗ ਮਹੱਤਵਪੂਰਨ ਹੁੰਦੇ ਹਨ ਜਿਵੇਂ ਕਿ ਸ਼ਾਂਤ ਮਾਹੌਲ ਦਰਸਾਉਣ ਲਈ ਹਲਕੇ ਨੀਲੇ ਅਤੇ ਪੀਲੇ ਰੰਗ ਵਰਤਦੇ ਹਾਂ ਧੁੱਪ ਬਣਾਉਣ ਲਈ ਹੌਲੀ ਸ਼ੇਡਿੰਗ ਅਤੇ ਰੰਗ ਮਿਲਾ ਕੇ ਨਰਮ ਲੁਕ ਦਿੱਤਾ ਜਾਂਦਾ ਹੈ ਸੂਰਜ ਦੀ ਰੌਸ਼ਨੀ ਚਮਕਾਉਣ ਲਈ ਨਾਰੰਗੀ ਲਾਲ ਅਤੇ ਸੁਨਹਿਰੇ ਰੰਗ ਵਰਤੇ ਜਾਂਦੇ ਹਨ ਜੇਕਰ ਇੱਕ ਉਦਾਸ ਜਾਂ ਡਰਾਵਨਾ ਮਾਹੌਲ ਬਣਾਉਣਾ ਹੋਵੇ ਤਾਂ ਗੂੜੇ ਰੰਗ ਅਤੇ ਵੱਡੀਆਂ ਪਰਛਾਈਆਂ ਦਿਖਾਈ ਜਾਂਦੀਆਂ ਹਨ